ਫਿਲਮਾਂ ਦੀ ਗੱਲ ਕਰੀਏ ਤਾਂ ਸਮਾਜ ਨੂੰ ਸੇਧ ਦੇਣ ਵਾਲੀਆਂ ਫਿਲਮਾਂ ਦੇਖਣਾ ਮੈਨੂੰ ਵਧੇਰੇ ਪਸੰਦ ਹੈ ਉੱਡਦਾ ਪੰਜਾਬ ਇਨ੍ਹਾਂ ਫਿਲਮਾਂ ਵਿੱਚੋ ਮੇਰੀ ਮੇਰੀਆਂ ਮਨਪਸੰਦ ਫਿਲਮਾਂ ਵਿੱਚੋਂ ਇੱਕ ਹੈ ਇਸ ਵਿੱਚ ਅੱਜ ਦੇ ਸਮੇਂ ਨੂੰ ਮੁੱਖ ਰੱਖ ਕੇ ਅੱਜ ਦੇ ਸਮੇਂ ਵਿੱਚ ਜੋ ਨਸ਼ਿਆਂ ਅਤੇ ਅਪਰਾਦਿਕ ਦੌਰ ਚਲ ਰਿਹਾ ਉਸ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਏ ਇਸ ਫਿਲਮ ਨੂੰ ਅਤੇ ਇਸ ਫਿਲਮ ਫਿਲਮ ਦੇ ਜੋ ਕਿਰਦਾਰ ਹਨ ਉਹਨਾਂ ਨੇ ਬਾਖੂਬੀ ਆਪਣਾ ਕਿਰਦਾਰ ਨਿਭਾਇਆ ਹੈ ਅਤੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਕੁਝ ਵੀ ਅੱਜ ਦੇ ਸਮੇਂ ਵਿੱਚ ਚੱਲ ਰਿਹਾ ਹੈ ਜਿਵੇਂ ਨਸ਼ੇ ਅਤੇ ਮਾਰ ਕੁੱਟ ਅਤੇ ਬੇਰੁਜ਼ਗਾਰੀ ਇਹਨਾਂ ਚੀਜ਼ਾਂ ਨੂੰ ਦਰਸ਼ਾ ਬਾਖੂਬੀ ਦਰਸ਼ਾਇਆ ਗਿਆ ਹੈ